ਸਾਡੇ ਖੇਤਰ ਦੇ ਵਿੱਚ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਇੰਜੀਨ ਇੰਜੀਨੀ ਕਾ ਕਈ ਤਰ੍ਹਾਂ ਦੇ ਇੰਜੀਨੀਅਰ ਆ ਗਏ ਨੇ ਕਈ ਇੰਜੀਨੀਅਰਾਂ ਨੇ ਕਈ ਸੜਕਾਂ ਵਧੀਆ ਵਧੀਆ ਬਣਾ ਦਿੱਤੀਆਂ ਨੇ ਕਈ ਸਕੂਲ ਇੰਨੇ ਵਧੀਆ ਬਣਾ ਦਿੱਤੇ ਨੇ ਐ ਸਕੂਲ ਬੜੇ ਵਧੀਆ ਬਣਾ ਤੇ ਨੇ ਕੋਈ ਪੰਜਾਬ ਬੋਰਡ ਐਜੂਕੇਸ਼ਨ ਜਾਂ ਸੀ ਬੀ ਐ ਈ ਜਾਂ ਆਈ ਸੀ ਆਈ ਸੀ ਦੀ ਪੜ੍ਹਾਈ ਬਹੁਤ ਅੱਛੇ ਟੀਚਰ ਨੇ ਬਹੁਤ ਵੈਲ ਐਜੂਕੇਟਡ ਬਹੁਤ ਜ਼ਿਆਦਾ ਪੜੇ ਲਿਖੇ ਨੇ ਸਟਾਫ ਵਗੈਰਾ ਸਾਇੰਸ ਦੇ ਵੀ ਬਹੁਤ ਤਰੱਕੀ ਕੀਤੀ ਹੈ ਮਸ਼ੀਨਾਂ ਦਾ ਰਸੋਈ ਦੇ ਵਿੱਚ ਵੀ ਮਸ਼ੀਨਾਂ ਕਈ ਤਰ੍ਹਾਂ ਦੀਆਂ ਬਹੁਤ ਵਧੀਆ ਆ ਗਈਆਂ ਨੇ ਜਿਵੇਂ ਇੰਡਕਸ਼ਨ ਆ ਗਿਆ ਮਿਕਸੀ ਗਰਾਈਂਡਰ ਆ ਗਿਆ ਹੈਂਡ ਬਲੈਂਡਰ ਆ ਗਿਆ ਕਈ ਮਸ਼ੀਨਾਂ ਨੇ ਹੋਰ ਵੀ ਕਈ ਮੋਪ ਆ ਗਏ ਕਾਫੀ ਤਰੱਕੀ ਕੀਤੀ ਹੈ ਜਾਂ ਇੱਕ ਰੋਬਿਟ ਆ ਗਿਆ ਸਫ਼ਾਈ ਵਾਲਾ ਉਹ ਵੀ ਕਾਫੀ ਉਹਦੀ ਕਾਫੀ ਰੇਂਜ ਹੈ ਪਰ ਚਲੋ ਬਹੁਤ ਸੁੱਖ ਵੀ ਹੈ ਕਾਫੀ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਸਾਇੰਸ ਦੇ ਨਾਲ ਹੀ ਸਾਰਾ ਮੰਨ ਲਉ ਕਿ ਇਹ ਮੋਬਾਇਲ ਵੀ ਹੈ ਵੀ ਸਾਇੰਸ ਦੇ ਰਾਹੀਂ ਹੀ ਬਣਿਆ ਹੈ ਟੀ ਵੀ ਮੋਬਾਈਲ ਐੱਲ ਈ ਡੀਆਂ ਐੱਲ ਸੀ ਡੀਆਂ ਸਭ ਕੁਛ ਇਹ ਸਾਇੰਸ ਦੇ ਵਾਜੋ ਇਹ ਤਰੱਕੀਆਂ ਕੀਤੀਆਂ ਗਈਆਂ ਨੇ ਪਰ ਇਹਨਾਂ ਦਾ ਬਹੁਤ ਅੱਗੇ ਜਾ ਕੇ ਬੱਚੇ ਆਉਣ ਵਾਲੀ ਪੀੜ੍ਹੀ ਨੂੰ ਵੀ ਬਹੁਤ ਲਾਭ ਮਿਲੇਗਾ ਤਾਂ ਕਿ ਯੁੱਗ ਹੀ ਸਾਰਾ ਸਾਇੰਸ ਦਾ ਹੈ ਮੈਡੀਕਲ ਦੇ ਵਿੱਚ ਲੈਬ ਕਈ ਤਰ੍ਹਾਂ ਦੀਆਂ ਲੈਬ ਬਣ ਚੁੱਕੀਆਂ ਨੇ ਕਈ ਤਰ੍ਹਾਂ ਦੀਆਂ ਮਸ਼ੀਨਾਂ ਮੰਨ ਲਓ ਕਿ ਕਈ ਤਰ੍ਹਾਂ ਦੀਆਂ ਮਸ਼ੀਨਾਂ ਆ ਚੁੱਕੀਆਂ ਨੇ ਜਿਵੇਂ ਹੋਸਪਿਟਲਾਂ ਦੇ ਵਿੱਚ ਵੀ ਵੱਧ ਤੋਂ ਵੱਧ ਮਸ਼ੀਨਾਂ ਵਧੀਆ ਤੋਂ ਵਧੀਆ ਨੇ ਕੋਈ ਵੈਟੀਨੇਟਰ ਹੋ ਗਿਆ ਜਾਂ ਕੁਛ ਵੀ ਹੋ ਗਿਆ ਜਿਹਦੇ ਨਾਲ ਮਰੀਜ਼ਾਂ ਨੂੰ ਬਹੁਤ ਸੁੱਖ ਸਹੂਲਤ ਮਿਲ ਕੇ ਕਈਆਂ ਦੀ ਤਾਂ ਜਾਨ ਬਚ ਜਾਂਦੀ ਹੈ